ਹਾਂਜੀ ਮੈਂ ਆਪਣੀਆਂ ਡਰਾਇੰਗਾਂ ਦੇ ਵਿੱਚ ਨਾ ਗਤੀਸ਼ੀਲਤਾ ਅਤੇ ਗਤੀਸ਼ੀਲਤਾ ਨੂੰ ਬਹੁਤ ਜ਼ਿਆਦਾ ਸ਼ਾਮਿਲ ਕੀਤਾ ਹੈਗਾ ਇਹਦੀ ਨਾ ਮੈਂ ਤੁਹਾਡੇ ਨਾਲ ਇੱਕ ਉਦਾਹਰਣ ਤੁਹਾਨੂੰ ਦੱਸ ਰਿਹਾ ਹੈਗਾ ਮੈਂ ਦੱਸਦਾ ਆਪਦੇ ਬਾਰੇ ਇੱਕ ਮੈਂ ਨਾ ਇੱਕ ਘੋੜੇ ਦੀ ਤਸਵੀਰ ਬਣਾਈ ਸੀਗੀ ਉਹਦੇ ਵਿੱਚ ਕੀ ਹੈ ਮੈਂ ਉਹਨੂੰ ਇੰਨਾਂ ਵਧੀਆ ਢੰਗ ਦੇ ਨਾਲ ਉਹਨੂੰ ਦੌੜਦਾ ਹੋਇਆ ਘੋੜੇ ਦੀ ਪੇਂਟਿੰਗ ਬਣਾਈ ਅਤੇ ਜਿਹੜੇ ਉਹਦੇ ਵਿੱਚ ਹਰਕਤਾਂ ਨਾ ਉਹਦੀਆਂ ਭਰਮ ਪੈਦਾ ਕਰਦੀਆਂ ਸੀਗੀਆਂ ਉਹਦੇ ਜਿਹੜੇ ਰਖਾਵਾਂ ਸੀਗੀਆਂ ਰਖਾਵਾਂ ਦੇ ਨਾਲ ਜੋ ਬਣਾਈ ਨਾ ਉਹ ਗਤੀਸ਼ੀਲ ਕੰਪੋਜੀਸ਼ਨ ਅਤੇ ਪ੍ਰੋਸਪੈਕਟਿਵ ਦੀ ਭਾਵਨਾ ਦੇ ਨਾਲ ਉਹਨੂੰ ਮੈਂ ਬਣਾਇਆ ਵੀ ਕਿਵੇਂ ਬਣਾਇਆ ਉਹ ਦੇਖਣ ਵਾਲੇ ਨੂੰ ਕਿਵੇਂ ਲੱਗੀ ਅਤੇ ਘੋੜੇ ਦੇ ਗਲੇ ਅਤੇ ਦਮ ਦੀ ਤਸਵੀਰ ਦੇ ਵਿੱਚ ਵਗਦੀਆਂ ਰੇਖਾਵਾਂ ਬਣਾਈਆਂ ਠੀਕ ਹੈ ਬੇਗ ਦਾ ਪਤਾ ਲੱਗਦਾ ਸੀ ਉਹ ਤੋਂ ਫਿਰ ਉਹਦੀਆਂ ਲੱਤਾਂ ਨੂੰ ਮੈਂ ਇਸ ਤਰ੍ਹਾਂ ਬਣਾਇਆ ਜਿਹੜਾ ਅੱਗੇ ਵੱਧ ਵੀ ਅੱਗੇ ਨੂੰ ਵੱਧਦੀਆਂ ਸੀ ਜਿਹੜਾ ਬੰਦਾ ਇਹ ਜਿਹੜਾ ਵਿਅਕਤੀ ਹੈ ਦੇਖਣਾ ਵਾਲਾ ਇਹ ਤਾਂ ਇਹ ਤੋਂ ਸਮਝੇ ਕਿ ਸਾਨੂੰ ਲਗਾਤਾਰ ਅੱਗੇ ਵਧਣਾ ਚਾਹੀਦਾ ਸਾਨੂੰ ਪਿੱਛੇ ਨਹੀਂ ਮੁੜ ਕੇ ਦੇਖਣਾ ਚਾਹੀਦਾ ਸਾਡੇ ਕਦਮ ਹਮੇਸ਼ਾ ਵੱਧਦੇ ਰਹਿਣਾ ਜਿਹੜੇ ਘੋੜੇ ਦੀ ਤਸਵੀਰ ਦੇ ਨਾ ਮੇਰੇ ਔਰ ਮੂਹਰਲੇ ਪੈਰ ਸੀ ਅੱਗੇ ਨੂੰ ਜਾਂਦੇ ਉਹ ਇਹ ਸ਼ੋ ਕਰਦੇ ਸੀਗੇ ਵੀ ਸਾਨੂੰ ਪਿੱਛੇ ਨਹੀਂ ਮੁੜ ਕੇ ਦੇਖਣਾ ਅਸੀਂ ਅੱਗੇ ਹੀ ਵੱਧਦੇ ਜਾਣਾਗਾ ਉਹਦੀ ਫਿਰ ਗਤੀ ਦੀ ਭਾਵਨਾ ਠੀਕ ਹੈ ਵੀ ਇਹ ਸਾਨੂੰ ਗਤੀ ਦੇ ਨਾਲ ਹੀ ਚਲਦੇ ਜਾਣਾ ਚਾਹੀਦਾ ਹੈ ਜਿਹੜਾ ਸਾਡਾ ਜੀਵਨ ਹੈ ਇਹਦੀ ਚਲਦੇ ਚਲਦੇ ਚਲਣ ਦੇ ਵਿੱਚ ਹੀ ਮਹੱਤਤਾ ਹੈਗੀ ਇਹਦੇ ਵਿੱਚ ਖੜੋਤ ਨਹੀਂ ਆਉਣੀ ਚਾਹੀਦੀ ਅਤੇ ਪਿਛਲਾ ਪਾਸਾ ਹੈਗਾ ਜਿਹੜਾ ਉਹਦਾ ਉਹਨੂੰ ਮੈਂ ਧੁੰਦਲਾ ਜਿਹਾ ਕੀਤਾ ਵੇ ਹੈਗਾ ਠੀਕ ਹੈ ਤਾਂ ਕਿ ਜਿਹੜਾ ਕੀ ਆ ਭੂਤ ਕਾਲ ਹੁੰਦਾ ਉਹ ਆਪਣਾ ਧੁੰਦਲਾ ਜਿਹਾ ਹੀ ਹੁੰਦਾ ਹੈਗਾ ਉਹਨੂੰ ਭੁੱਲ ਜਾਣਾ ਚਾਹੀਦਾ ਸਾਨੂੰ ਭਵਿੱਖ ਦੇ ਵੱਲ ਹੀ ਅੱਗੇ ਨੂੰ ਵਧਣਾ ਚਾਹੀਦਾ ਹੈਗਾ ਤਾਂ ਮੇਰੀ ਜਿਹੜੀ ਇਹ ਤਸਵੀਰ ਮੈਂ ਬਣਾਈ ਨਾ ਘੋੜੇ ਦੀ ਵੱਖ ਵੱਖ ਉਹ ਆਪਦੀਆਂ ਐਕਟੀਵਿਟੀਜ਼ ਇਹਦੇ ਵਿੱਚ ਮੈਂ ਸ਼ੋ ਕੀਤੀਆਂ ਵੀ ਮੇਰੇ ਜਿਹੜੇ ਦੇਖਣ ਵਾਲੇ ਨੂੰ ਕੇਂਦਰ ਲੱਗਣ ਅਤੇ ਬਹੁਤ ਵਧੀਆ ਸੀਗੀ ਹਰ ਇੱਕ ਨੇ ਇਹਨੂੰ ਸਲਾਇਆ ਗਾ ਅਤੇ ਮੈਨੂੰ ਵੀ ਬਹੁਤ ਵਧੀਆ ਲੱਗਦੀ ਹੈਗੀ ਅਤੇ ਠੀਕ ਹੈ ਦੇਖਣ ਯੋਗ ਹੈਗੀ ਭਾਵ ਇਹ ਬਹੁਤ ਇੱਕ ਤਸਵੀਰ ਆ ਹਜ਼ਾਰਾਂ ਸ਼ਬਦ ਬੋਲ ਜਾਂਦੀ ਹੈ ਤਾਂ ਉਹ ਚੀਜ਼ ਮੈਂ ਆਪਣੀ ਇਸ ਤਸਵੀਰ ਦੇ ਵਿੱਚ ਦਿਖਾਈ ਹੋਈ ਹੈ ਧੰਨਵਾਦ ਜੀ